ਇੱਕ ਜਨਵਰੀ ਦੋ ਹਜ਼ਾਰ ਸਤਾਰ੍ਹਾਂ ਪੰਜ ਮਈ ਦੋ ਹਜ਼ਾਰ ਉੱਨੀ ਸੱਤ ਮਈ ਦੋ ਹਜ਼ਾਰ ਸਤਾਰ੍ਹਾਂ ਅੱਠ ਮਈ ਦੋ ਹਜ਼ਾਰ ਬਾਈ ਔਰ ਪੰਦਰ੍ਹਾਂ ਮਈ ਦੋ ਹਜ਼ਾਰ ਚੌਵੀ